ਕੁਝ ਕਲਾ ਸ਼ਿਲਪਕਾਰੀ ਜਾਂ ਕੱਪੜੇ ਦੀਆਂ ਸਮੱਗਰੀਆਂ ਅਜਿਹੀਆਂ ਹਨ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਹਨ ਜਿਸ ਤਰ੍ਹਾਂ ਸਾਡੇ ਸੱਭਿਆਚਾਰ ਦੇ ਵਿੱਚ ਇਹ ਹਮੇਸ਼ਾਂ ਹੀ ਰਿਹਾ ਹੈ ਕਿ ਕੁੜੀਆਂ ਵਿਆਹ ਤੋਂ ਪਹਿਲਾਂ ਆਪਣਾ ਦਾਜ ਤਿਆਰ ਕਰਦੀਆਂ ਨੇ ਜਿਸ ਪ੍ਰਕਾਰ ਸਾਡੀਆਂ ਭੂਆ ਨੇ ਵੀ ਆਪਣੇ ਦਾਜ ਦੇ ਲਈ ਚਾਦਰਾਂ ਕੱਢੀਆਂ ਫੁਲਕਾਰੀਆਂ ਕੱਢੀਆਂ ਜਾਂ ਫਿਰ ਚੰਗੇਰਾਂ ਜਿਹੜੀਆਂ ਨੇ ਓਹ ਰੰਗੀਲੇ ਧਾਗੇ ਦੇ ਨਾਲ ਬਣਾਈਆਂ ਜਾਂਦੀਆਂ ਸਨ ਉਸੇ ਪ੍ਰਕਾਰ ਮੈਂ ਵੀ ਆਪਣੇ ਵਿਆਹ ਦੇ ਲਈ ਦਾਜ ਜੋੜਨ ਦੇ ਲਈ ਕੁਛ ਕਸੀਦਾਕਾਰੀ ਕੀਤੀ ਹੋਈ ਹੈ ਜਿਸ ਪ੍ਰਕਾਰ ਮਤਲਬ ਫੁਲਕਾਰੀਆਂ ਵੀ ਕੱਢੀਆਂ ਅਤੇ ਇਸੇ ਤਰ੍ਹਾਂ ਹੀ ਜਿਹੜੀਆਂ ਕੇਸਮੈਂਟ ਦੀਆਂ ਚਾਦਰਾਂ ਵੀ ਕੱਢੀਆਂ ਵੱਖਰੇ ਵੱਖਰੇ ਤਰ੍ਹਾਂ ਦੇ ਤਰੋਪਿਆਂ ਦੇ ਨਾਲ ਤਾਂ ਲੱਡੂ ਵੰਡਣ ਦੇ ਲਈ ਕੁਝ ਜਿਹੜੀਆਂ ਨੇ ਮਤਲਬ ਛਿੱਕੂ ਟਾਈਪ ਵੀ ਤਿਆਰ ਕੀਤੇ ਜਾਂਦੇ ਸਨ ਚੰਗੇਰ ਵੀ ਮੈਂ ਤਿਆਰ ਕੀਤੀ ਜਾਂ ਕਰੋਸ਼ੀਏ ਦੇ ਕਛ ਰੁਮਾਲ ਜਿਹੜੇ ਨੇ ਉਹ ਵੀ ਤਿਆਰ ਕੀਤੇ ਅਤੇ ਸੰਗਲੀ ਤਰੋਪੇ ਦੇ ਨਾਲ ਜਾਂ ਪੋਲੇ ਤਰੋਪੇ ਦੇ ਨਾਲ ਜਾਂ ਗੰਢ ਤਰੋਪੇ ਦੇ ਨਾਲ ਵੀ ਕੁਝ ਰੁਮਾਲ ਅਤੇ ਚਾਦਰਾਂ ਜਾਂ ਫਿਰ ਹੋਰ ਜਿਹੜੇ ਪੜਛੱਤੀਆਂ ਦੇ ਸੈੱਟ ਵਗੈਰੇ ਉਹ ਤਿਆਰ ਕੀਤੇ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਹਨ